ਬਿਲਕੁਲ ਸਹੀ ਟੀ ਵੀ ਅਤੇ ਆਨਲਾਈਨ 'ਤੇ ਸਾਡੀ ਖੇਤਰੀ ਭਾ ਭਾਸ਼ਾਵਾਂ ਵਿੱਚ ਵਧੇਰੇ ਵਿੱਦਿਅਕ ਸਮੱਗਰੀ ਬਣਾਈ ਜਾਣੀ ਚਾਹੀਦੀ ਹੈ ਕਿਉਂਕਿ ਅੱਜ ਕੱਲ੍ਹ ਦੇ ਟੀ ਵੀ ਅਤੇ ਆਨਲਾਈਨ ਵਿੱਚ ਇੰਗਲਿਸ਼ ਭਾਸ਼ਾਵਾਂ ਦਾ ਵਧੇਰੇ ਵਿਕਾਸ ਕੀਤਾ ਜਾ ਰਿਹਾ ਹੈ ਜੋ ਸਾਡੀ ਸੱਭਿਅਤਾ ਲਈ ਸਹੀ ਨਹੀਂ ਹੈ ਬੱਚੇ ਆਪਣੀ ਮਾਤਰ ਭਾਸ਼ਾ ਪੰਜਾਬੀ ਭਾਸ਼ਾ ਤੋਂ ਜਾਣੂ ਨਹੀਂ ਹੋ ਰਹੇ ਉਹਨਾਂ ਨੂੰ ਦੂਜੀਆਂ ਭਾਸ਼ਾਵਾਂ ਇੰਗਲਿਸ਼ ਅੰਗਰੇਜ਼ੀ ਭਾਸ਼ਾਵਾਂ ਜਾਂ ਵਿ ਬਾਹਰੀ ਭਾਸ਼ਾਵਾਂ ਵੱਲ ਵੇ ਵਧੇਰੇ ਜਾਗਰੂਕ ਹੋ ਰਹੇ ਹਨ ਇਸ ਲਈ ਬੱਚਿਆਂ ਨੂੰ ਜਾਗਰੂਕ ਕਰਨ ਲਈ ਉਹਨਾਂ ਲਈ ਵਿ ਟੀ ਵੀ ਅਤੇ ਆਨਲਾਈਨ ਰਾਹੀਂ ਭਾਸ਼ਾ ਵੱਖ ਵੱਖ ਖੇਤਰੀ ਭਾਸ਼ਾਵਾਂ ਦਾ ਵਿਕਾਸ ਕੀਤਾ ਜਾਣਾ ਚਾਹੀਦਾ ਉਹਨਾਂ ਦੇ ਜਿਹੜੇ ਬੱਚਿਆਂ ਨੂੰ ਚੰਗੇ ਲੱਗਦੇ ਪ੍ਰੋਗਰਾਮ ਉਹਨਾਂ ਨੂੰ ਖੇਤਰੀ ਭਾਸ਼ਾ ਭਾਸ਼ਾਵਾਂ ਵਿੱਚ ਪੇਸ਼ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਬੱਚੇ ਸਾਰਾ ਦਿਨ ਵੀਡੀਓ ਗੇਮ ਵੀ ਆਨਲਾਈਨ ਵੇਖਦੇ ਹਨ ਟੀ ਵੀ ਵੇਖਦੇ ਹਨ ਜਿਹੜੇ ਵੀ ਉਹਨਾਂ ਦੇ ਬੱਚਿਆਂ ਦੇ ਸ਼ੌਕ ਵਾਲੇ ਪ੍ਰੋਗਰਾਮ ਹਨ ਉਹਨਾਂ ਨੂੰ ਖੇਤਰੀ ਭਾਸ਼ਾਵਾਂ ਵਿੱਚ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਉਹ ਆਪਦੀ ਸੱਭਿਅਤਾ ਸੰਸਕ੍ਰਿਤ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣਗੇ ਕਿਉਂਕਿ ਖੇਤਰੀ ਭਾਸ਼ਾਵਾਂ ਨਾਲ ਹੀ ਬੱਚੇ ਦੀ ਪਹਿਚਾਣ ਹੈ ਖੇਤਰੀ ਭਾਸ਼ਾਵਾਂ ਨਾਲ ਹੀ ਪਤਾ ਚੱਲਦਾ ਹੈ ਬੱਚਾ ਕਿੱਥੋਂ ਦਾ ਹੈ ਹੁਣ ਵਿੱਦਿਅਕ ਜਾਗਰਿਤੀ ਬਾਰੇ ਵੀ ਵਿੱਦਿਅਕ ਜੋ ਵੀ ਸਮੱਗਰੀ ਹੈ ਉਹਨਾਂ ਨੂੰ ਓਨਲਾਈਨ ਅਤੇ ਟੀ ਵੀ ਰਾਹੀਂ ਭੇਜੀ ਜਾਣੀ ਚਾਹੀਦੀ ਹੈ ਖੇਤਰੀ ਭਾਸ਼ਾਵਾਂ ਵਿੱਚ ਤਾਂ ਕਿ ਬੱਚੇ ਆਪਦੀ ਖੇਤਰੀ ਭਾਸ਼ਾਵਾਂ ਨੂੰ ਨਾ ਛੱਡ ਸਕਣ ਅਤੇ ਦੂਜੀਆਂ ਭਾਸ਼ਾਵਾਂ ਨੂੰ ਛੱਡ ਦੇਣ ਜਿਸ ਨਾਲ ਆਪਦੀ ਭਾਸ਼ਾ ਦਾ ਵਿਕਾਸ ਕੀਤਾ ਜਾ ਸਕਦਾ ਹੈ